ਬੈਕਿੰਗ ਦਾ ਅਤੇ ਬੀਮਾ ਦਾ ਭਵਿੱਖ ਬਹੁਤ ਹੀ ਉਜਵੱਲ ਹੈ ਸਭ ਤੋਂ ਪਹਿਲਾਂ ਜਿਵੇਂ ਬੈਂਕ ਦੀ ਗੱਲ ਕਰਾਂ ਤਾਂ ਬੈਂਕਾਂ ਵਿੱਚ ਐੱਫ ਡੀ ਆਰ ਡੀ ਪੀ ਪੀ ਏ ਆਦਿ ਅਸੀਂ ਕਰਵਾ ਸਕਦੇ ਹਾਂ ਬੈਂਕਾਂ ਵਿੱਚ ਲੋਕਰ ਦੀ ਸੁਵਿਧਾ ਵੀ ਉਪਲੱਬਧ ਹੈ ਬੈਂਕਾਂ ਵਿੱਚ ਬੈਂਕਾਂ ਦਾ ਦਾਇਰਾ ਜਿੰਨਾ ਵੱਧ ਰਿਹਾ ਹੈ ਲੋਕਾਂ ਦੀਆਂ ਮੰਗਾਂ ਵੀ ਉਸ ਹਿਸਾਬ ਨਾਲ ਵੱਧ ਰਹੀਆਂ ਹਨ ਅੱਜ ਕੱਲ੍ਹ ਬਹੁਤ ਸਾਰੇ ਪ੍ਰਾਈਵੇਟ ਬੈਂਕ ਵੀ ਹੋਂਦ ਵਿੱਚ ਆ ਗਏ ਹਨ ਅਤੇ ਜੇ ਮੈਂ ਬੀਮਾ ਕੰਪਨੀਸ ਦੀ ਗੱਲ ਕਰਾਂ ਅਤੇ ਬਹੁਤ ਸਾਰੀਆਂ ਬੀਮਾ ਕੰਪਨੀਸ ਵੀ ਹੋਂਦ ਵਿੱਚ ਆ ਗਈਆਂ ਹਨ ਪਰ ਸਭ ਤੋਂ ਜਿਹੜੀ ਟਰੱਸਟਫੁੱਲ ਕੰਪਨੀ ਹੈ ਉਹ ਐੱਲ ਆਈ ਸੀ ਹੀ ਅੱਜ ਵੀ ਉਹੀ ਮੰਨੀ ਜਾਂਦੀ ਹੈ ਇਸ ਕਰਕੇ ਲੋਕਾਂ ਦਾ ਇਨਵੈਸਟਮੈਂਟ ਨੂੰ ਲੈ ਕੇ ਨਜ਼ਰੀਆ ਇਹੀ ਹੈ ਕਿ ਐੱਲ ਆਈ ਸੀ ਵਿੱਚ ਜਾਂ ਬੈਂਕਾਂ ਵਿੱਚ ਹੀ ਜ਼ਿਆਦਾਤਰ ਪੈਸਾ ਇਨਵੈਸਟ ਕੀਤਾ ਜਾਵੇ